ਗਿਆਰ੍ਹਾਂ ਨਵੰਬਰ ਉੱਨੀ ਸੌ ਸਤੱਤਰ ਅੱਠ ਅਗਸਤ ਉੱਨੀ ਸੌ ਅਠੱਤਰ ਦੋ ਸਤੰਬਰ ਦੋ ਹਜ਼ਾਰ ਦੋ ਅਠਾਰ੍ਹਾਂ ਸਤੰਬਰ ਦੋ ਹਜ਼ਾਰ ਛੇ ਇੱਕੀ ਫਰਵਰੀ ਦੋ ਹਜ਼ਾਰ ਸੱਤ